ਅਸੀਂ ਜਿੱਥੇ ਵੀ ਉਗਾਉਣਾ ਹੈ ਉਹ ਜਗ੍ਹਾ ਨੂੰ ਵੇਖ ਕੇ ਪੌਦੇ ਜਾਂ ਵੇਲਾਂ ਸੋਚਦੇ ਹਾਂ ਡਿਸਾਈਡ ਕਰਦੇ ਹਾਂ ਅਤੇ ਉਸ ਹਿਸਾਬ ਨਾਲ ਹੀ ਉਗਾਉਂਦੇ ਹਾਂ ਬਿਊਟੀਫਿਕੇਸ਼ਨ ਦੀ ਲੋੜ ਹੋਏ ਅਤੇ ਭੋਗਣਵਿਲ ਵੇਲ ਚਿਪਕਵੇਲ ਛਿਪਕਲੀ ਵੇਲ ਇਹ ਸਭ ਕਾਫੀ ਇਸਤੇਮਾਲ ਕਰਦੇ ਹਾਂ ਕੋਟਨ ਕਰੀਪਰ ਵੀ ਕਹਿ ਲਓ ਜਿਹੜਾ ਉਹ ਵੀ ਕਾਫੀ ਇਸਤੇਮਾਲ ਕਰਦੇ ਹਾਂ ਬਾਕੀ ਪੌਦਿਆਂ 'ਚ ਟਰਮੀਨੇਲੀਆ ਜਕਰੈਂਡਾ ਗੁਲਮੋਹਰ ਅਮਲਤਾਸ ਅਮਰੂਦ ਨਿੰਬੂ ਕੇਲੇ ਕਈ ਤਰ੍ਹਾਂ ਦੇ ਪਾਮ ਬੈਂਬੂ ਪਲਾਂਟਸ ਇਹ ਸਭ ਅਸੀਂ ਇਸਤੇਮਾਲ ਕਰ ਰਹੇ ਹਾਂ ਆਪਣੇ ਕਈ ਪ੍ਰੋਜੈਕਟਸ ਵਿੱਚ ਅਤੇ ਉਗਾ ਰਹੇ ਆ ਅਤੇ ਪ੍ਰਪੋਜ ਕਰ ਰਹੇ ਹਾਂ ਬਾਕੀ ਗਰਾਊਂਡ ਕਵਰ ਹੁੰਦੇ ਨੇ ਛੋਟੇ ਛੋਟੇ ਕਈ ਤਰ੍ਹਾਂ ਦੇ ਉਹ ਵੀ ਅਸੀਂ ਇਸਤੇਮਾਲ ਕਰਦੇ ਹਾਂ ਫੋਕਸ ਫੋਕਸ ਸਟਿਲ ਪਾਮ ਹੋ ਗਏ ਅਰੀਕਾ ਪਾਮ ਹੋ ਗਏ ਹੋਰ ਵੀ ਕਈ ਹਨ ਇੱਦਾਂ ਜੋ ਅਸੀ ਇਸਤੇਮਾਲ ਕਰ ਰਹੇ ਆ ਅਤੇ ਉਗਾ ਰਹੇ ਹਾਂ